ਅਗਰ ਮੈਂ ਇੱਕ ਲੰਬੀ ਬਾਈਕਿੰਗ ਯਾਤਰਾ ਜਾਂ ਟੂਰ 'ਤੇ ਜਾਂਦਾ ਤਾਂ ਸਭ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਤਾਂ ਆਪਣੇ ਮਾਇੰਡ ਨੂੰ ਰਿਲੈਕਸ ਕਰਦਾ ਅਤੇ ਉਸ ਤੋਂ ਬਾਅਦ ਮੇਰਾ ਜੋ ਵੀ ਸਮਾਨ ਹੈ ਜਿੱਦਾਂ ਕਿ ਜਿਹੜਾ ਸਭ ਤੋਂ ਜ਼ਰੂਰੀ ਆ ਉਹ ਹੈਗਾ ਫਸਟ ਐਡ ਬਾਕਸ ਇਹ ਸਭ ਤੋਂ ਜ਼ਰੂਰੀ ਚੀਜ਼ ਆ ਅਤੇ ਉਸ ਤੋਂ ਬਾਅਦ ਇੱਕ ਸੈਡਲ ਬੈਗ ਇੱਕ ਹੈਲਮਟ ਅਤੇ ਜੋ ਕਿ ਟਾਇਰ ਲਈ ਬਹੁਤ ਹੀ ਜੋ ਕਿ ਜ਼ਰੂਰੀ ਹਨ ਉਹਦੇ ਲਈ ਇੱਕ ਟਾਇਰ ਰਿਪੇਅਰ ਕਿੱਟ ਹੁੰਦੀ ਹੈ ਜੋ ਕਿ ਉਹ ਸਭ ਤੋਂ ਪਹਿਲਾਂ ਜ਼ਰੂਰੀ ਮੇਨ ਆ ਸੋ ਇਹਨਾਂ ਚੀਜ਼ਾਂ ਨੂੰ ਮੈਂ ਆਪਣੇ ਕੋਲ ਰੱਖਦਾ ਹਾਂ ਤਾਂ ਕਿ ਮੈਨੂੰ ਕਿੱਥੇ ਵੀ ਲੰਬੀ ਯਾਤਰਾ ਸਮੇਂ ਲੋੜ ਪੈ ਜੇ ਤਾਂ ਮੈਂ ਆਪ ਹੀ ਇਸ ਨੂੰ ਸਹੀ ਕਰ ਸਕਾਂ ਸੋ ਇਸ ਕਰਕੇ ਮੈਂ ਜਦੋਂ ਵੀ ਕਿਸੇ ਲੰਬੀ ਬਾਈਕਿੰਗ ਯਾਤਰਾ 'ਤੇ ਜਾਂਦਾ ਹਾਂ ਤਾਂ ਇਹ ਸਾਰਾ ਸਮਾਨ ਮੈਂ ਆਪਣੇ ਨਾਲ ਹੀ ਰੱਖਦਾ ਹਾਂ ਥੈਂਕ ਯੂ ਸੋ ਮੱਚ